ਹਾਂ ਮੈਨੂੰ ਹਰ ਸਮੇਂ ਮਨ ਪਸੰਦ ਪਕਵਾਨ ਛੋਲੇ ਭਟੂਰੇ ਹੈ ਕਿਉਂਕਿ ਇਹ ਇੱਕ ਪ੍ਰਸਿੱਧ ਉੱਤਰੀ ਭਾਰਤ ਪਕਵਾਨ ਨੂੰ ਆਮ ਤੌਰ 'ਤੇ ਮਸਾਲੇਦਾਰ ਛੋਲਿਆਂ ਅਤੇ ਡੂੰਘੀ ਤਲੀ ਹੋਈ ਰੋਟੀ ਦੇ ਸ ਸੁਮੇਲ ਵਜੋਂ ਪਰੋਸਿਆ ਜਾਂਦਾ ਹੈ ਸੁਗੰਧਿਤ ਮਸਾਲਿਆਂ ਦੇ ਮਿਸ਼ਰਨ ਨਾਲ ਪਕਾਏ ਹੋਏ ਛੋਲਿਆਂ ਨੂੰ ਇੱਕ ਪਲੇਟ ਵਿੱਚ ਬਣਿਆ ਜਾਂਦਾ ਹੈ ਅਤੇ ਫੁੱਲੇ ਹੋਏ ਸੁਨਹਿਰੀ ਭੂਰੇ ਭਟੂਰੇ ਨਾਲ ਨਾਲ ਨਾਲ ਪਰੋਸਿਆ ਜਾਂਦਾ ਹੈ ਇਹ ਅਕਸਰ ਕੱਟੇ ਹੋਏ ਪਿਆਜ਼ ਅਚਾਰ ਅਤੇ ਕਈ ਵਾਰ ਦਹੀਂ ਦੇ ਨਾਲ ਹੁੰਦਾ ਹੈ ਇਹ ਦਿਲਕਸ਼ ਅਤੇ ਸੁਆਦਲਾ ਪਕਵਾਨ ਨਾਸ਼ਤੇ ਜਾਂ ਦੁਪਹਿਰ ਦੇ ਵਿੱਚ ਖਾਣ ਲਈ ਮਾਣਿਆ ਜਾਂਦਾ ਹੈ ਇਸ ਨਾਲ ਕਈ ਵਾਰ ਚਟਣੀ ਵੀ ਆਉਂਦੀ ਹੈ ਅਤੇ ਨਰਮ ਭਟੂਰੇ ਨੂੰ ਪਾਟਿਆ ਜਾਂਦਾ ਹੈ ਅਤੇ ਸੁਆਦ ਮਸਾਲੇ ਦਾ ਛੋਲਿਆਂ ਨੂੰ ਸੰਪੂਰਨ ਕਰਨ ਲਈ ਵਰਤਿਆ ਜਾਂਦਾ ਹੈ ਇੱਕ ਸੰਤੁਲਿਸਟ ਅਤੇ ਅਨੰਦਦਾਇਕ ਰਸੋਈ ਅਨੁਭਵ ਬਣਾਉਂਦਾ ਹੈ